ਮੱਛੀਆਂ ਫੜਨ ਨਾਲ ਬਹੁਤ ਬਦਲਾਵ ਹੋਇਆ ਜਿਵੇਂ ਕਿ ਜਦ ਮੱਛੀਆਂ ਤਲਾਬ ਵਿੱਚ ਮਛੇਰੇ ਫੜਨ ਜਾਂਦੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਗੰਦਗੀ ਹੁੰਦਾ ਤਾਂ ਉਹਨਾਂ ਕਰਕੇ ਬਹੁਤ ਪਾਣੀ ਗੰਦਾ ਹੋ ਰਿਹਾ ਏ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਏ ਜਦੋਂ ਮਛੇਰੇ ਮੱਛੀਆਂ ਫੜਨ ਜਾਂਦੇ ਆ ਜਦ ਜਾਲ ਸੁੱਟਦੇ ਨੇ ਕੋਈ ਮੱਛੀ ਜਾਂ ਕੋਈ ਮਰੀ ਜੀ ਆ ਗਈ ਜਾਲ 'ਚ ਉਹਨਾਂ ਨੇ ਫਿਰ ਉਹੀ ਮੱਛੀ ਫਿਰ ਸਿੱਟ ਦੇਣਾ ਪਾਣੀ 'ਚ ਉਹੀ ਪਾਣੀ ਫਿਰ ਦੂਸ਼ਿਤ ਹੁੰਦਾ ਹੈ ਜੋ ਕਿ ਸਾਡੇ ਲਈ ਨੁਕਸਾਨਦਾਇਕ ਹੈ ਇਹ ਮਛੇਰਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਆਪਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਪਾਣੀ ਵਿੱਚ ਗੰਦਗੀ ਨਾ ਸੁੱਟੀਏ ਕੂੜਾ ਕੂੜਾ ਨਾ ਸਿੱਟੀਏ ਕੂੜਾ ਕਰਕਟ ਨਾ ਸਿੱਟੀਏ ਜਿਸ ਕਾਰਨ ਪਾਣੀ ਗੰਦਾ ਹੁੰਦਾ ਹੈ ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਹੈ